ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੈਨੂੰ ਫੋਟੋਗ੍ਰਾਫਰੀ ਦਾ ਬਹੁਤ ਸੌਂਕ ਆ ਫੋਟੋਆਂ ਖਿੱਚਣ ਦਾ ਕਿਤੇ ਵੀ ਭਾਰਤ ਦੇ ਅੰਦਰ ਮੈਂ ਘੁੰਮਣ ਜਾਂਦਾ ਹਾਂ ਜਾਂ ਬਾਹਰ ਅੰਦਰ ਜਾਂਦਾ ਪਾਰਕ ਵਗੈਰਾ ਹੋ ਗਿਆ ਕਿਤੇ ਵੀ ਅਸੀਂ ਫੋਟੋ ਖਿੱਚਣ ਦਾ ਮੈਨੂੰ ਬਹੁਤ ਸ਼ੌਂਕ ਹੈ ਅਮਰਨਾਥ ਯਾਤਰਾ 'ਤੇ ਜਾਂਦੇ ਹਾਂ ਬਹੁਤ ਤਰ੍ਹਾਂ ਦੀਆਂ ਫੋਟੋ ਖਿੱਚਦੇ ਹਾਂ ਝਰਨੇ ਦੀਆਂ ਪਹਾੜਾਂ ਦੀਆਂ ਸੀਨਰੀਜ ਵਗੈਰਾ ਜਾਨਵਰ ਹੋ ਗਏ ਫੁੱਲ ਹੋ ਗਏ ਪਕਸ਼ੀ ਹੋ ਗਏ ਪੇੜ ਹੋ ਗਏ ਬਹੁਤ ਸ਼ੌਂਕ ਹੈ ਮੈਨੂੰ ਕਿਤੇ ਵੀ ਜਾਂਦਾ ਹਾਂ ਮੈਨੂੰ ਫੋਟੋਆਂ ਖਿੱਚਣ ਦਾ ਬਹੁਤ ਸ਼ੌਂਕ ਹੈ ਘਰ ਤੋਂ ਬਾਹਰ ਚਲੇ ਜਾਈਏ ਕਿੱਤੇ ਵੀ ਚਾਹੇ ਸ਼ਮਸ਼ਾਨ ਘਾਟ ਹੋਏ ਸ਼ਮਸ਼ਾਨ ਘਾਟ ਦੇ ਵਿੱਚ ਵੀ ਫੋਟੋਆਂ ਅਸੀਂ ਬਹੁਤ ਖਿੱਚਦੇ ਹਾਂ ਮੈਨੂੰ ਆਪਦੀਆਂ ਫੋਟੋਆਂ ਖਿੱਚਣ ਦਾ ਵੀ ਬਹੁਤ ਸੌਂਕ ਆ ਬੱਚਿਆਂ ਦੀਆਂ ਫੋਟੋਆਂ ਹੋ ਗਈਆਂ ਸੀਨਰੀਜ਼ ਵਗੈਰਾ ਹੋ ਗਈ ਪਿਛਲੀ ਵਾਰੀ ਮੈਂ ਅਮਰਨਾਥ ਯਾਤਰਾ 'ਤੇ ਗਿਆ ਸੀ ਉੱਥੋਂ ਇੱਕ ਫੋਟੋਆਂ ਜਿਵੇਂ ਖਿੱਚ ਕੇ ਲਿਆਉਂਦੇ ਹਾਂ ਇੱਕ ਫੋਟੋ ਸੀਨਰੀ ਦਾ ਰੂਪ ਲੈ ਰਹੀ ਇੱਕ ਇੰਨੀ ਆਕਰਸ਼ਿਤ ਸੀਨਰੀ ਬਣ ਗਈ ਕਿ ਮੈਨੂੰ ਪਤਾ ਹੀ ਨਹੀਂ ਸੀ ਉਹਦੇ ਵਿੱਚ ਝਰਨਿਆਂ ਤੋਂ ਪਾਣੀ ਬਹਿ ਰਿਹਾ ਸੀ ਪਛਸ਼ੀ ਪਾਣੀ ਪੀ ਰਹੇ ਸੀ ਆਸੇ ਪਾਸੇ ਫੁੱਲ ਬੂਟੇ ਵਗੈਰਾ ਹੋਰ ਬਹੁਤ ਵਧੀਆ ਉਹ ਸੀਨਰੀ ਬਣ ਚੁੱਕੀ ਸੀ ਇੱਕ ਅਤੇ ਮੈਨੂੰ ਫੋਟੋਆਂ ਖਿੱਚਣ ਦਾ ਬਹੁਤ ਸ਼ੌਂਕ ਹੈ ਘਰ ਵਿੱਚ ਵੀ ਚਾਹੇ ਬਾਹਰ ਅੰਦਰ ਜਾਵਾਂ ਉੱਥੇ ਵੀ ਬੱਚਿਆਂ ਦੀਆਂ ਫੋਟੋਆਂ ਵੀ ਬਹੁਤ ਵਧੀਆ ਖਿੱਚਦਾ ਹਾਂ ਬਾਹਰ ਅੰਦਰ ਜਾਂਦੇ ਰਹਿੰਦੇ ਹਾਂ ਕਿਤੇ ਵੀ ਰੇਲਵੇ ਸਟੇਸ਼ਨ ਹੋ ਗਿਆ ਜਾਂ ਕੋਈ ਹੋਰ ਬਸ ਸਟੈਂਡ ਦਿਸਦਾ ਇਸ ਤਰ੍ਹਾਂ ਜਿੱਥੇ ਵੀ ਭੀੜ ਭੜੱਕੇ